ਮਨੁੱਖ ਦੀ ਸੁੰਦਰਤਾ ਨੂੰ ਵਧਾਉਣ ਦੀ ਵਾਲਾਂ ਦਾ ਬਹੁਤ ਵੱਡਾ ਹਿੱਸਾ ਹੈ ਅਸੀਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਕਈ ਤਰ੍ਹਾਂ ਦੇ ਉਤਪਾਦ ਵਰਤਦੇ ਹਾਂ ਇਹ ਉਤਪਾਦ ਸਾਡੇ ਵਾਸਤੇ ਕਈ ਕਈ ਵਾਰੀ ਹਾਨੀਕਰਕ ਵੀ ਹੋ ਸਕਦੇ ਅਤੇ ਸਾਨੂੰ ਲਾਭ ਵੀ ਦੇ ਸਕਦੇ ਹਨ ਮੈ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਇੱਕ ਇਹੋ ਜਿਹਾ ਤੇਲ ਵਰਤਿਆ ਜਦ ਮੈਂ ਇਸ ਤੇਲ ਨੂੰ ਦੁਕਾਨਦਾਰ ਕੋਲੋਂ ਖਰੀਦਿਆ ਅਤੇ ਬੋਤਲ ਉੱਤੇ ਵੇਰਵਾ ਪੜ੍ਹਿਆ ਤਾਂ ਪਤਾ ਲੱਗਾ ਕਿ ਇਸ ਵਿੱਚ ਕਈ ਤਰ੍ਹਾਂ ਦੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੈ ਇਹ ਰਸਾਇਣਿਕ ਪਦਾਰਥਾਂ ਦਾ ਸਿਰ ਉੱਤੇ ਲਾਉਣ ਨਾਲ ਮੇਰੇ ਨਾਲ ਇੱਕ ਅਜੀਬ ਕਿਸਮ ਦੇ ਹੋ ਗਏ ਵਾਲ ਰੁੱਖੇ ਹੋਣੇ ਸ਼ੁਰੂ ਹੋ ਗਏ ਅਤੇ ਵਧਣ ਦੀ ਜਗ੍ਹਾ ਘਟਣੇ ਸ਼ੁਰੂ ਹੋ ਗਏ ਸਿਰ ਵਿੱਚ ਅਜੀਬ ਕਿਸਮ ਦਾ ਦਰਦ ਸ਼ੁਰੂ ਹੋ ਗਿਆ ਇਸ ਉਤਪਾਦ ਦਾ ਸਿਰ ਵਿੱਚ ਜੂਆਂ ਵੀ ਪੈ ਗਈਆਂ ਅਤੇ ਪਤਾ ਲੱਗਾ ਕਿ ਇਹ ਉਤਪਾਦ ਮੇਰੇ ਵਾਲਾਂ ਵਾਸਤੇ ਬੜਾ ਹਾਨੀਕਾਰਕ ਸਿੱਧ ਹੋਇਆ